ਮੈਂ ਹਜੇ ਕੁਛ ਹੀ ਦਿਨ ਹੋਏ ਨੇ ਇੰਸਟਾਗ੍ਰਾਮ 'ਤੇ ਮੈਂ ਐਡਵਰਟਾਈਜਮੈਂਟ ਦੇਖੀ ਸੀ ਜਿਸ ਦੇ ਵਿੱਚ ਮਮਾਅਰਥ ਦੇ ਕੁਛ ਪ੍ਰੋਡਕਟ ਸੀਗੇ ਉਹ ਡਿਸਕਾਊਂਟ 'ਤੇ ਮਿਲ ਰਹੇ ਸੀ ਜਿਵੇਂ ਕਿ ਇੱਕ ਸੀਗਾ ਫੇਸ ਕਰੀਮ ਅਤੇ ਇੱਕ ਫੇਸ ਵਾਸ਼ ਮੈਨੂੰ ਵੈਸੇ ਵੀ ਜ਼ਰੂਰਤ ਸੀਗੀ ਤਾਂ ਮੈਂ ਸੋਚਿਆ ਵੀ ਚੱਲ ਜੇ ਡਿਸਕਾਊਂਟ 'ਤੇ ਹੈਗਾ ਤਾਂ ਲੈ ਲਈਏ ਪਰ ਫਿਰ ਮੈਨੂੰ ਲੱਗਿਆ ਅ ਵੀ ਇਹ ਟਾਈਮ ਵੀ ਮੇਰੇ ਕੋਲ ਆਉਣਗੇ ਵੀ ਕਿ ਨਹੀਂ ਸਮੇਂ 'ਤੇ ਪਹੁੰਚਣਗੇ ਵੀ ਕਿ ਨਹੀਂ ਪਰ ਪਰ ਮੈਂ ਇਹਨਾਂ ਨੂੰ ਔਡਰ ਤਾਂ ਦੇ ਤਾ ਅ ਇਹਨਾਂ ਦੀ ਵੈਬਸਾਈਟ ਡਾਊਨਲੋਡ ਵੈਬਸਾਈਟ ਦਾ ਐਪ ਡਾਊਨਲੋਡ ਕਰ ਕੇ ਅਤੇ ਫਿਰ ਐਪ ਦੇ ਵਿੱਚ ਮੈਨੂੰ ਨੋਟੀਫਿਕੇਸ਼ਨ ਵੀ ਆਈਆਂ ਇਹਨਾਂ ਨੇ ਦੱਸਿਆ ਵੀ ਪ੍ਰੋਪਰ ਵੀ ਕਦੋਂ ਪਹੁੰਚੇਗਾ ਪਰ ਇਹ ਫਿਰ ਵੀ ਚਾਰ ਪੰਜ ਦਿਨ ਲੇਟ ਹੋ ਗਿਆ ਸੀ ਚਾਰ ਪੰਜ ਦਿਰ ਦਿਨ ਲੇਟ ਹੋਣ ਤੋਂ ਬਾਅਦ ਵੀ ਮਤਲਬ ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਕਿਤੇ ਵੀ ਬੋਕਸ ਓਪਨ ਕਰਨ 'ਤੇ ਵੀ ਸਹੀ ਵੀ ਪ੍ਰੋਡਕਟ ਹੋਏਗਾ ਕਿ ਨਹੀਂ ਹੋਏਗਾ ਤਾਂ ਫਿਰ ਫੇਸ ਕਰੀਮ ਅਤੇ ਫੇਸ ਕਰੀਮ ਦੇ ਵਿੱਚ ਮੇਰਾ ਸੀਗਾ ਸੰਸਕ੍ਰੀਮ ਅਤੇ ਫੇਸ਼ ਵੋਸ਼ ਦੋਵੇਂ ਮੇਰੇ ਕੋਲ ਆ ਗਏ ਸੀ ਅਤੇ ਸੰਸਕ੍ਰੀਮ ਨੂੰ ਮੈਂ ਹੁਣ ਕਾਫੀ ਚਿਰ ਯੂਜ਼ ਤਾਂ ਕੀਤਾ ਬਟ ਮਗਰ ਫਿਰ ਮੇਰਾ ਜਿਹੜਾ ਫੇਸ ਕਰੀ ਫੇਸ ਆ ਜਿਹੜਾ ਉਹ ਕਾਫੀ ਫਿੰਣਸੀਆਂ ਨਾਲ ਭਰ ਚੁੱਕਿਆ ਸੀ ਤਾਂ ਉਸ ਦੇ ਕਰਕੇ ਮੈਨੂੰ ਇੰਨਾ ਲੱਗਿਆ ਕਿ ਮੈਨੂੰ ਨਹੀਂ ਇਸ ਦਾ ਵਰਤੋਂ ਕਰਨੀ ਚਾਹੀਦੀ ਇੱਕ ਤਾਂ ਅ ਸੰਸਕ੍ਰੀਮ ਦਾ ਕਾਫੀ ਹੱਦ ਤੱਕ ਮਤਲਬ ਸਹੀ ਨਹੀਂ ਸੀ ਅਤੇ ਬਾਕੀ ਫੇਸ ਵੋਸ਼ ਵੀ ਇੰਨਾ ਖ਼ਾਸ ਨਹੀਂ ਚੱਲਿਆ ਅਤੇ ਅ ਮਤਲਬ ਡਿਸਕਾਊਂਟ ਦੇ ਬਾਵਜੂਦ ਵੀ ਮੈਨੂੰ ਇਸ ਦਾ ਇੰਨਾ ਬੈਨੀਫਿਟ ਨਹੀਂ ਅ ਹੋਇਆ ਅਤੇ ਮੈਂ ਸੋਚਿਆ ਵੀ ਹੁਣ ਇਸ ਕੰਪਨੀ ਦਾ ਜਿਹੜੇ ਦੁਬਾਰਾ ਪ੍ਰੋਡਕਟ ਨਾ ਖਰੀਦਾ